ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹਦੇ ਵਿਅਕਤੀਗਤ ਵਿਦਿਆਰਥੀਆਂ ਦੀਆਂ ਲੋੜਾਂ ਇਹਦੇ ਵਿੱਚ ਤਾਂ ਏ ਜਾਣੀ ਕਿ ਏਮਸ ਜਿਹੜੇ ਹੈ ਇਹਨਾਂ ਨੂੰ ਪ ਪੂਰੇ ਕਰਨ ਵਾਸਤੇ ਇੰਨੀਆਂ ਸਹੀ ਤਰੀਕੇ ਨਾਲ ਹੱਲ ਕਰਨ ਵਾਸਤੇ ਨਹੀਂ ਚੱਲ ਰਿਹਾ ਸੀ ਪਹਿਲੋਂ ਤਾਂ ਲੇਕਿਨ ਹੁਣ ਕੁਝ ਹੱਲ ਜਿਹੜੇ ਨਜ਼ਰ ਆਉਂਦੇ ਆ ਕਿ ਇਹਦੇ ਵਾਸਤੇ ਫੈਸਿਲਿਟੀਸ ਲਾਈਕ ਇੰਨ ਜਿਹੜੀ ਹੈ ਸਪੋਰਟਸ ਵਗੈਰਾ ਜਿਹੜੀ ਆ ਮੁਹੱਈਆ ਕਰਵਾਈ ਜਾਂਦੀ ਹੈ ਜਿਹਦੇ ਨਾਲ ਬੱਚਿਆਂ ਦਾ ਇੱਕ ਬੈਲੈਂਸਡ ਰਹੇ ਡਿਵੈਲਪਮੈਂਟ ਔਰ ਇਹ ਬਾਕੀ ਹੈ ਕਿ ਉਹਨਾਂ ਨੂੰ ਸਾਰਿਆਂ ਵਾਸਤੇ ਬਰਾਬਰ ਦੀਆਂ ਔਪਰਚੁਨਿਟੀਜ ਹੈ ਗਰੀਬ ਅਮੀਰ ਹੈ ਚਾਹੇ ਚਾਹੇ ਕੋਈ ਕਿਸੇ ਵੀ ਕਾਸਟ ਨਾਲ ਤਅੱਲਕ ਰੱਖਦਾ ਹੈ ਰਿਜਰਵ ਕੋਟਾ ਹੈ ਜਾਂ ਜਰਨਲ ਕੋਟਾ ਹੈ ਜਾਂ ਕਿਤੇ ਡਿਸਟੈਂਟ ਏਰੀਆ ਵਾਲਾ ਹੈ ਉਹਦੇ ਵਾਸਤੇ ਵੀ ਉਸ ਤਰ੍ਹਾਂ ਨਾਲ ਫੈਸਿਲਿਟੀ ਦਿੱਤੀਆਂ ਜਾਂਦੀਆਂ ਹਨ ਅਤੇ ਈਵਨ ਕਈ ਫਾਇਨੈਂਸ਼ੀਅਲ ਕੋਈ ਸਕੋਲਰਸ਼ਿਪ ਟਾਈਪ ਚੀਜ਼ਾਂ ਵੀ ਚੱਲਦੀਆਂ ਮੈਂ ਕੋਈ ਕਨਸੈਸ਼ਨਜ਼ ਵਗੈਰਾ ਵੀ ਹੁੰਦੀਆਂ ਬਾਕੀ ਬੱਚਿਆਂ ਨੂੰ ਕੌਂਸਲਿੰਗ ਦੇ ਕੇ ਪੂਰੀ ਤਰ੍ਹਾਂ ਨਾਲ ਸਮਝਾਇਆ ਜਾਂਦਾ ਵੈ ਕਿ ਉਹ ਆਪਣਾ ਅੱਛੀ ਤਰ੍ਹਾਂ ਨਾਲ ਸਮਝ ਸਕਣ ਕਿ ਉਹਨਾਂ ਦਾ ਏਮ ਕੀ ਆ ਐਜੂਕੇਸ਼ਨ ਦਾ ਅਤੇ ਉਹਨਾਂ ਨੂੰ ਕਿਸ ਲਾਈਨ ਵੱਲ ਜਾਣਾ ਚਾਹੀਦਾ ਵੈ ਅਤੇ ਪ੍ਰੋਪਰਲੀ ਉਹਦੇ ਉੱਤੇ ਆਪਣੀ ਕਾਮਯਾਬੀ ਹਾਸਲ ਕਰ ਸਕਣ ਪੜ੍ਹਾਈ ਦੇ ਮਕਸਦ ਨੂੰ ਪੂਰਾ ਕਰ ਸਕਣ ਅਤੇ ਆਪਣੇ ਮਾਂ ਪਿਉ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਕਿਸੇ ਨੂੰ ਵੀ ਇਸ ਤਰ੍ਹਾਂ ਨਾ ਲੱਗੇ ਕਿ ਉਹਦੇ ਨਾਲ ਕੋਈ ਇਨਜਸਟਿਸ ਹੋ ਰਿਹਾ ਵੈ ਅਤੇ ਉਹ ਆਪਣੇ ਆਪ ਨੂੰ ਅਨਕੰਫਰਟੇਬਲੀ ਜਾਂ ਅਨਫਿੱਟ ਨਾ ਸਮਝੇ ਕਿ ਸੁਸਾਇਟੀ ਵਿੱਚ ਜਾਂ ਕਿਸੇ ਫੀਲਡ ਵਿੱਚ ਅਗਾਉਂ ਤਰੱਕੀ ਕਰਨ ਵਿੱਚ ਉਹਨੂੰ ਕੋਈ ਕਮਜ਼ੋਰੀ ਨਾ ਮਹਿਸੂਸ ਹੋਵੇ ਇਸ ਤਰ੍ਹਾਂ ਨਾਲ ਕਾਫੀ ਫੈਸਿਲਿਟੀਆਂ ਬਣਾਈਆਂ ਜਾ ਰਹੀਆਂ